ਪੰਜਾਬ ਦਾ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ ਚਾਹੇ ਇਸ ਵਿੱਚ ਮੰਜੇ ਬੁਣਨਾ ਪੱਖੀ ਬੁਣਨਾ ਛਿੱਕੂ ਬੁਣਨਾ ਨਾਲੇ ਬੁਣਨਾ ਚਾਹੇ ਚਰਖਾ ਕੱਤਣਾ ਜਾਂ ਮੰਜੇ ਬੁਣਨਾ ਹੋਵੇ ਇਹ ਸਾਰਾ ਪੰਜਾਬ ਦਾ ਬਹੁਤ ਹੀ ਅਮੀਰ ਵਿਰਸਾ ਹੈ ਚਾਹੇ ਇਸ ਵਿੱਚ ਗ ਗਿੱਧਾ ਹੋਵੇ ਭੰਗੜਾ ਹੋਵੇ ਜਾਂ ਫਿਰ ਫੁੱਲਕਾਰੀ ਕੱਢਣਾ ਬਾਗ ਕੱਢਣਾ ਇਹ ਸਭ ਕੁਛ ਪੰਜਾਬ ਦਾ ਵਿਰਸਾ ਹੈ ਪੰਜਾਬੀਆਂ ਨੇ ਆਪਦਾ ਵਿਰਸਾ ਕੁਝ ਹੱਦ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ ਕਿ ਮੈਂ ਕੁਝ ਹੱਦ ਤੱਕ ਇਸ ਲਈ ਕਹਿ ਰਹੀ ਹਾਂ ਕਿਉਂਕਿ ਕਿਤੇ ਨਾ ਕਿਤੇ ਸ਼ਹਿਰੀ ਸ਼ਹਿਰੀ ਜੀਵਨ ਵਿੱਚ ਪੰਜਾਬੀ ਵਿਰਸੇ ਦਾ ਜੋ ਪ੍ਰਭਾਵ ਹੈ ਉਹ ਘੱਟਦਾ ਜਾ ਰਿਹਾ ਹੈ ਇਸ ਲਈ ਇਹ ਮੇਰੇ ਵਿਚਾਰ ਹਨ ਬਾਕੀ ਇਹ ਸਭ ਦੇ ਅੱਡ ਅੱਡ ਵਿਚਾਰ ਹੋ ਸਕਦੇ ਹਨ ਇਸ ਦੇ ਨਾਲ ਜਿਵੇਂ ਸੰਸਾਰ ਹੁਣ ਇਹ ਗਲੋਬਲ ਗਲੋਬਲ ਤੌਰ 'ਤੇ ਸੰਸਾਰ ਵਿੱਚ ਗਲੋਬਲ ਰੁਝਾਨਾਂ ਅਤੇ ਪ੍ਰਭਾਵਾਂ ਨਾਲ ਕਿਵੇਂ ਜੁੜਦੀ ਹੈ ਜਿਵੇਂ ਅੱਜ ਕੱਲ੍ਹ ਆਪਾਂ ਆਮ ਹੀ ਵੇਖਣ ਵਿੱਚ ਮਿਲਦਾ ਹੈ ਕਿ ਪੰਜਾਬ ਵਿੱਚ ਹਰ ਦੂਜਾ ਹਰ ਤੀਜਾ ਘਰ ਵੀ ਬਾਹਰ ਆਪਦੇ ਬੱਚਿਆਂ ਨੂੰ ਬਾਹਰ ਭੇਜ ਰਿਹਾ ਹੈ ਸਭ ਸਾਰੀ ਨੌਜਵਾਨ ਪੀੜ੍ਹੀ ਕੀ ਹੈ ਬਾਹਰ ਬਾਹਰ ਜਾ ਕੇ ਆਪਦੀ ਕਮਾਈ ਕਰਨਾ ਚਾਹੁੰਦੀ ਹੈ ਬਾਹਰ ਜਾ ਕੇ ਪੈਸੇ ਕਮਾਉਣਾ ਚਾਹੁੰਦੀ ਹੈ ਜਾਂ ਬਾਹਰ ਜਾ ਕੇ ਆਪਦਾ ਕੰਮ ਲੱਭਣਾ ਚਾਹੁੰਦੀ ਹੈ ਇਸ ਤਰ੍ਹਾਂ ਕੀ ਹੈ ਪੰਜਾਬੀ ਵਿਰਸੇ ਦਾ ਵੀ ਰੁਝਾਨ ਇਸ ਤਰ੍ਹਾਂ ਵੱਧ ਰਿਹਾ ਹੈ ਜਿਵੇਂ ਕਿ ਆਪਾਂ ਵੇਖ ਲਈਏ ਕਿ ਪੰਜਾਬੀ ਜਦੋਂ ਬਾਹਰ ਜਾਂਦੇ ਹਨ ਜਦੋਂ ਇੱਕ ਨੌਜਵਾਨ ਬਾਹਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਆਪਦੇ ਪਰਿਵਾਰ ਨੂੰ ਬਾਹਰ ਬੁਲਾਉਂਦਾ ਹੈ ਜਦੋਂ ਇੱਕ ਪੰਜਾਬੀ ਪਰਿਵਾਰ ਬਾਹਰ ਜਾਂਦਾ ਹੈ ਤਾਂ ਉਸ ਦੇ ਨਾਲ ਉਹ ਸਿਰਫ ਇੱਕ ਇਨਸਾਨ ਹੀ ਬਾਹਰ ਨਹੀਂ ਜਾਂਦਾ ਉਸ ਦੇ ਨਾਲ ਉਸਦਾ ਵਿਰਸਾ ਉਸਦਾ ਕਲਚਰ ਉਸਦਾ ਖਾਣ ਉਸ ਦਾ ਪਾਉਣ ਉਸਦਾ ਪਹਿਨਣ ਦਾ ਢੰਗ ਉਸਦਾ ਰਹਿਣ ਦਾ ਢੰਗ ਉਸਦਾ ਪਹਿਰਾਵਾ ਉਸਦਾ ਬੋਲ ਬੋਲ ਉਸਦਾ ਚਾਲ ਉਸਦਾ ਵਿਵਹਾਰ ਸਭ ਕੁਛ ਉਸਦੇ ਨਾਲ ਹੀ ਬਾਹਰ ਜਾਂਦਾ ਹੈ ਇਸ ਤਰ੍ਹਾਂ ਹੀ ਪੰਜਾਬ ਦਾ ਵਿਰਸਾ ਵੀ ਇਸ ਤਰ੍ਹਾਂ ਉਹਨਾਂ ਉਸ ਪਰਿਵਾਰ ਦੇ ਨਾਲ ਬਾਹਰ ਜਾਂਦਾ ਹੈ ਜਦੋਂ ਇਸ ਤਰ੍ਹਾਂ ਹੁਣ ਹਰ ਕੋਈ ਬਾਹਰ ਜਾ ਰਿਹਾ ਤਾਂ ਇਸ ਤਰ੍ਹਾਂ ਉਸ ਤਰ੍ਹਾਂ ਹੀ ਜਿਹੜਾ ਵਿਰਸਾ ਹੈ ਉਹ ਉਸਦਾ ਬਾਹਰ ਰੁਝਾਨ ਵੱਧ ਰਿਹਾ ਹੈ ਬਾਹਰ ਇਸ ਤਰ੍ਹਾਂ ਲੋਕ ਜੋ ਕੀ ਹੈ ਜਦੋਂ ਆਪਸ ਵਿੱਚ ਇੰਨੇ ਪਰਿਵਾਰ ਇਕੱਠੇ ਜੁੜ ਜਾਂਦੇ ਹਾਂ ਜਿਵੇਂ ਆ ਆਪਾਂ ਮੰਨ ਲਈਏ ਜਿਵੇਂ ਆਪਾਂ ਵੇਖਦੇ ਹਾਂ ਕਨੇਡਾ ਵਿੱਚ ਵੈਨਕੂਵਰ ਨੂੰ ਪੰਜਾਬੀ ਹੈ ਜੋ ਮਿੰਨੀ ਪੰਜਾਬ ਕਿਹਾ ਜਾਂਦਾ ਹੈ ਵਿਨੀਪੈਗ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ ਕਿਉਂ ਕਿਉਂਕਿ ਉੱਥੇ ਇੰਨੇ ਪੰਜਾਬੀ ਪਰਿਵਾਰ ਹਨ ਜੋ ਇਕੱਠੇ ਉੱਥੇ ਰਲ ਕੇ ਆਪਦਾ ਵਿਰਸਾ ਸੰਭਾਲੀ ਬੈਠੇ ਹਨ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਕੀ ਆ ਪੰਜਾਬੀ ਵਿਰਸਾ ਜੋ ਹੈ ਪੰਜਾਬੀ ਸ਼ਿਲਪਕਾਰੀ ਜਾਂ ਫਿਰ ਪੰਜਾਬੀ ਪੰਜਾਬ ਦੀ ਕਲਾ ਹੈ ਉਹ ਕੀ ਆ ਗਲੋਬਲ ਰੁਝਾਨਾਂ 'ਤੇ ਪ੍ਰਭਾਵ ਆ ਪ੍ਰਭਾਵ ਪਾ ਰਹੀ ਹੈ